ਟੈਕਨੋਲੋਜੀ ਦੇ ਦੌਰਾਨ ਸਾਡਾ ਕੰਮ ਬਹੁਤ ਸੌਖਾ ਹੋ ਗਿਆ ਹੈ ਜਿਵੇਂ ਕਿ ਹੁਣ ਨਵੇਂ ਮੋਬਾਈਲ ਆ ਗਏ ਹਨ ਜਿਸ ਦੇ ਕਾਰਨ ਆਪਾਂ ਇੱਕ ਦੂਜੇ ਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹਨ ਅਤੇ ਗੱਲ ਕਰਨ ਦਾ ਤਰੀਕਾ ਬਹੁਤ ਆਸਾਨ ਹੋ ਗਿਆ ਹੈ ਪਹਿਲਾਂ ਅਸੀਂ ਫੋਨ ਰਾਹੀਂ ਗੱਲ ਕਰਦੇ ਸੀ ਜਿਸ ਦਾ ਸਬੂਤ ਰਿਕੋਡ ਹੋ ਜਾਂਦਾ ਸੀ ਪਰ ਹੁਣ ਕਈ ਐਪ ਇਹੋ ਜਿਹੇ ਹਨ ਜਿਹਦੇ ਵਿੱਚ ਰਿਕੋਰਡਿੰਗ ਨਹੀਂ ਹੁੰਦੀ ਅਤੇ ਖੇਤਾਂ ਵਿੱਚ ਵੀ ਨਵੇਂ ਮਸ਼ੀਨਰੀ ਆ ਗਈ ਹੈ ਜਿਵੇਂ ਕਿ ਟਰੈਕਟਰ ਜਿਹਦੇ ਕਾਰਨ ਕਿਸਾਨਾਂ ਨੂੰ ਬਹੁਤ ਆਸਾਨੀ ਹੋ ਗਈ ਹੈ ਅਤੇ ਉਹਨਾਂ ਦਾ ਕੰਮ ਬਹੁਤ ਆਸਾਨ ਹੋ ਗਿਆ